ਸਕੂਲ ਦੇ ਸਮੇਂ ਵਿੱਚ ਮੇਰਾ ਮਨਪਸੰਦ ਵਿਸ਼ਾ ਪੰਜਾਬੀ ਸੀ ਪੰਜਾਬੀ ਮੇਰੀ ਮਾਂ ਭਾਸ਼ਾ ਹੈ ਪੰਜਾਬੀ ਪੜ੍ਹਨ ਨਾਲ ਹੀ ਮੈਨੂੰ ਮੇਰੇ ਗੁਰੂਆਂ ਬਾਰੇ ਜਾਣਕਾਰੀ ਮਿਲਦੀ ਹੈ ਇਸ ਤੋਂ ਇਲਾਵਾ ਮੈਂ ਪੰਜਾਬ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਅਤੇ ਪੰਜਾਬੀ ਦਾ ਪ੍ਰਚਾਰ ਵੱਧ ਤੋਂ ਵੱਧ ਕਰਨਾ ਚਾਹੁੰਦਾ ਹਾਂ ਮੈਨੂੰ ਸਭ ਤੋਂ ਵੱਧ ਮੈਥ ਵਿਸ਼ਾ ਔਖਾ ਲੱਗਦਾ ਸੀ ਮੈਥ ਦਾ ਅਧਿਆਪਕ ਜੋ ਵੀ ਕੁਝ ਬੋਰਡ 'ਤੇ ਸਮਝਾਉਂਦਾ ਸੀ ਉਹ ਮੈਨੂੰ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਸਕੂਲ ਦੇ ਸਮੇਂ ਵਿੱਚ ਮੈਂ ਅਤੇ ਮੇਰੇ ਇੱਕ ਦੋਸਤ ਨੇ ਅਧਿਆਪਕ ਦੀ ਅਲਮਾਰੀ ਵਿੱਚੋਂ ਮੈਥ ਦੇ ਪੇਪਰ ਚੋਰੀ ਕਰ ਲਏ ਸਨ ਅਤੇ ਬਾਕੀ ਕਲ ਸਾਰੀ ਕਲਾਸ ਵਿੱਚ ਵੰਡ ਦਿੱਤੇ ਸੀ ਇਸ ਦੌਰਾਨ ਮਾ ਸਰ ਨੇ ਸਾਨੂੰ ਬਹੁਤ ਹੀ ਬੜੀ ਪਨਿਸਮੈਂਟ ਦਿੱਤੀ ਸੀ ਉਸ ਨੇ ਸਾਡੇ ਹੱਥਾਂ 'ਤੇ ਬਾਰ੍ਹਾਂ ਬਾਰ੍ਹਾਂ ਡੰਡੇ ਮਾਰੇ ਸਨ ਅਤੇ ਬਾਅਦ ਵਿੱਚ ਮੁਰਗਾ ਬਣਾ ਕੇ ਗਰਾਊਂਡ ਵਿੱਚ ਦੌੜਾਇਆ ਸੀ